ਸਤਿ ਸ਼੍ਰੀ ਅਕਾਲ ਜੀ ਹਾਂਜੀ ਕਰਵਾਚੌਥ ਅਤੇ ਝੱਕਰੀ ਦੇ ਤਿਉਹਾਰ ਦੇ ਮੌਕੇ ਮਾਤਾ ਦੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਨੇ ਕਰਵਾਚੌਥ ਦੇ ਮੌਕੇ ਤਾਂ ਨਹੀਂ ਮਨਾਈ ਜਾਂਦੀ ਬਟ ਮਾਤਾ ਦੇ ਝੱਕਰੀ ਦੇ ਜਿਹੜਾ ਵਰਤ ਆ ਉਸ ਵਿੱਚ ਬਿਸ਼ਨੋਈ ਮਾਤਾ ਦੀ ਮੂਰਤੀ ਬਣਾਈ ਜਾਂਦੀ ਹੈ ਜੋ ਔਰਤਾਂ ਆਪਣੇ ਬੱਚਿਆਂ ਲਈ ਰੱਖਦੀਆਂ ਇਸ ਵਿੱਚ ਉਹ ਕੱਚੀ ਮਿੱਟੀ ਨਾਲ ਲੈ ਕੇ ਕੰਧ 'ਤੇ ਮੂਰਤੀਆਂ ਬਣਾਉਂਦੀਆਂ ਨੇ ਜੋ ਮੈਂ ਵੀ ਬਣਾਈਆਂ ਹੋਈਆਂ ਨੇ ਅਤੇ ਬਹੁਤ ਵਧੀਆ ਲੱਗਦਾ ਅਤੇ ਇਸ ਨਾਲ ਆਪਣੇ ਬੱਚਿਆਂ ਦਾ ਨਾਮ ਲਿਖਦੀਆਂ ਨੇ ਮਾਤਾ ਨੂੰ ਫਲਾਂ ਦਾ ਪ੍ਰਸ਼ਾਦ ਚੜ੍ਹਾਉਂਦੀਆਂ ਨੇ ਅਤੇ ਝੱਕਰੀਆਂ ਭਰਦੀਆਂ ਨੇ ਅਤੇ ਜੇ ਕਿਸੇ ਔਰਤ ਨੂੰ ਪਹਿਲੀ ਵਾਰ ਆਪਣੇ ਬੇਟੇ ਲਈ ਵਰਤ ਰੱਖਦੀ ਤਾਂ ਉਹ ਗਿਆਰਾਂ ਜਾਂ ਇੱਕੀ ਝੱਕਰੀਆਂ ਭਰਦੀ ਅਤੇ ਨਾਲ ਇੱਕ ਸਟੀਲ ਦਾ ਭਾਂਡਾ ਆਪਣੇ ਸ਼ਰੀਕੇ ਕਬੀਲੇ 'ਚ ਵੰਡਦੀ ਆ ਅਤੇ ਇਸ ਵਰਤ ਨੂੰ ਰੱਖਣ ਨਾਲ ਵੀ ਬਹੁਤ ਵਧੀਆ ਕਿਉਂਕਿ ਨਵੇਂ ਸੂਟ ਪਾ ਕੇ ਆਪਣੇ ਬੱਚਿਆਂ ਲਈ ਰੱਖਦੇ ਕਿ ਉਹਨਾਂ ਦੀ ਸਿਹਤ ਵਧੀਆ ਰਹੇ ਵੱਡੀ ਉਮਰ ਹੋਵੇ ਅਤੇ ਉਹ ਆਪਣੀ ਜ਼ਿੰਦਗੀ ਵਿੱਚ ਸਕਸੈਸ ਹੋਣ ਇਹ ਵਰਤ ਤਾਂ ਰੱਖਿਆ ਜਾਂਦਾ ਹੈ ਤਾਂ ਹਾਂ ਇਹਦਾ ਅਨੁਭਵ ਬਹੁਤ ਵਧੀਆ ਅਤੇ ਮੂਰਤੀ ਬਣਾਉਣ 'ਚ ਵੀ ਬਹੁਤ ਮਜ਼ਾ ਮਜ਼ਾ ਆਉਂਦਾ ਹੈ ਥੈਂਕ ਯੂ